ਖਾਣਾ ਬਣਾਉਣ ਦੀ ਕਲਾ ਵੀ ਹਰ ਇੱਕ ਕੋਲ ਨਹੀਂ ਹੁੰਦੀ ਪਰ ਮੈਨੂੰ ਇਹ ਕਲਾ ਦਾ ਗਿਆਨ ਹੈ ਮੈਂ ਆਪਣੇ ਖਾਣਾ ਬਣਾਉਣ ਦੇ ਵਿੱਚ ਬਹੁਤ ਪਰਪੱਕ ਹਾਂ ਮੈਂ ਆਪਣੇ ਘਰ ਰਸੋਈ ਦੇ ਵਿੱਚ ਘੱਟ ਤੋਂ ਘੱਟ ਸਮਾਂ ਬਿਤਾਉਂਦੀ ਹਾਂ ਜਿਹਦੇ ਨਾਲ ਕਿ ਮੈਂ ਸਭ ਤੋਂ ਜ਼ਿਆਦਾ ਸਵਾਦਿਸ਼ਟ ਭੋਜਨ ਤਿਆਰ ਕਰ ਸਕਾਂ ਖਾਣਾ ਬਣਾਉਣ ਦੇ ਵਿੱਚ ਜਿਸ ਤਰ੍ਹਾਂ ਹੁਣ ਇਡਲੀ ਡੋਸਾ ਡੋਸਾ ਬਣਾਉਣ ਦੇ ਲੱਗਿਆ ਸਾਨੂੰ ਟਾਈਮ ਲੱਗਦਾ ਪਰ ਇਡਲੀ ਸਾਂਬਰ ਬਣਾਉਣ ਲੱਗਿਆ ਸਾਨੂੰ ਕੋਈ ਟਾਈਮ ਨਹੀਂ ਲੱਗਦਾ ਜਿਸ ਤਰ੍ਹਾਂ ਇਡਲੀ ਨੂੰ ਸੂਜੀ ਨੂੰ ਘੋਲ ਲਿਆ ਉਹਦੇ ਵਿੱਚ ਨਮਕ ਥੋੜ੍ਹੇ ਜਿਹੇ ਮੇਥੀ ਦਾਣਾ ਪਾਇਆ ਉਹਨੂੰ ਘੋਲ ਕੇ ਰੱਖਤਾ ਦੂਸਰੇ ਪਾਸੇ ਦਾਲ ਰੱਖੀ ਦਾਲ ਦੇ ਵਿੱਚ ਸਬਜ਼ੀਆਂ ਪਾਈਆਂ ਉਹਨੂੰ ਵਿਸਲ ਦਿਵਾਈ ਨਾਲ ਹੀ ਤੁਸੀਂ ਤੜਕਾ ਤਿਆਰ ਕਰੋ ਤੜਕਾ ਤਿਆਰ ਕਰਨ ਦੇ ਨਾਲ ਦਾਲ ਵਿੱਚ ਮਿਕਸ ਕਰਤੀ ਇਨ ਦਾ ਮੀ ਇਹ ਇਸੇ ਉਹ ਸਮੇਂ ਦੌਰਾਨ ਹੀ ਸਾਡਾ ਇਡਲੀ ਦਾ ਜਿਹੜਾ ਸਮਾਨ ਆ ਉਹ ਤਿਆਰ ਹੋ ਜਾਂਦਾ ਇਡਲੀ ਸਟੈਂਡ ਰੱਖੋ ਇੱਕ ਵੇਲੇ ਸਾਡੇ ਕੋਲ ਸੌਲਾਂ ਇਡਲੀਆਂ ਤਿਆਰ ਹੋ ਜਾਂਦੀਆਂ ਹਨ ਅਤੇ ਅਸੀਂ ਅੱਧੇ ਘੰਟੇ ਦੇ ਵਿੱਚ ਇਡਲੀ ਸਾਂਬਰ ਦਾ ਖਾਣਾ ਤਾਂ ਆਪਣੇ ਪ੍ਰਾਹੁਣਿਆਂ ਨੂੰ ਖਵਾ ਸਕਦੇ ਹਾਂ